ਜਦੋਂ ਵੀ ਅਸੀਂ ਖਾਣਾ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਅਸੀਂ ਖਾਣਾ ਬਣਾਉਣ ਵਾਲੀ ਜਗ੍ਹਾ ਦਾ ਸਾਫ਼ ਸਫ਼ਾਈ ਦਾ ਧਿਆਨ ਰੱਖਦੇ ਹਾਂ ਜਿਸ ਵੀ ਬਰਤਨ ਦੇ ਵਿੱਚ ਖਾਣਾ ਬਣਾਇਆ ਜਾਂਦਾ ਹੈ ਉਸ ਬਰਤਨ ਨੂੰ ਚੰਗੀ ਤਰ੍ਹਾਂ ਸਫ਼ਾਈ ਕੀਤੀ ਜਾਂਦੀ ਹੈ ਖਾਣਾ ਬਣਾਉਣ ਲਈ ਜੋ ਵੀ ਅਸੀਂ ਤੇਲ ਵਗੈਰਾ ਦੀ ਵਰਤੋਂ ਕਰਦੇ ਹੈ ਉਹ ਅਸੀਂ ਸ਼ੁੱਧ ਵਰਤੋਂ ਕਰਦੇ ਹੈ ਖਾਣਾ ਬਣਾਉਣ ਲਈ ਜੋ ਸਬਜ਼ੀ ਵਗੈਰਾ ਦੀ ਜ਼ਰੂਰਤ ਹੁੰਦੀ ਹੈ ਉਸ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਸਦੀ ਖਾਣਾ ਬਣਾਉਣ ਲਈ ਵਰਤਿਆ ਜਾਂਦਾ ਹੈ